ਭਾਰਤ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਵਸਦੇ ਹਨ ਹਰ ਇੱਕ ਦਾ ਵੱਖਰਾ ਵੱਖਰਾ ਧਰਮ ਹੈ ਅਤੇ ਜੋ ਸਥਾਨਕ ਲੋਕ ਹਨ ਉਹ ਧਰਮ ਨੂੰ ਇਸ ਤਰ੍ਹਾਂ ਅਪਣਾਉਂਦੇ ਹਨ ਜਿਵੇਂ ਕਿ ਅਸੀਂ ਮੈਂ ਜੋ ਸਿੱਖ ਧਰਮ ਨੂੰ ਵਿੱਚ ਆਸਥਾ ਰੱਖਦਾ ਹਾਂ ਸਿੱਖ ਧਰਮ ਨੂੰ ਨੂੰ ਮੈਂ ਸੰਬੰਧ ਰੱਖਦਾ ਹਾਂ ਮੈਂ ਅਕਸਰ ਹੀ ਇਹ ਗੱਲ ਦੇਖਦਾ ਹਾਂ ਕਿ ਜਿਹੜੇ ਸਥਾਨਕ ਲੋਕ ਹੈ ਉਹ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਨ ਉੱਥੇ ਦੇਖਦੇ ਹਨ ਵੀ ਇੱਥੇ ਕੋਈ ਊਚ ਨੀਚ ਕੋਈ ਨਹੀਂ ਹੈ ਇੱਥੇ ਸਾਰੇ ਲੋਕ ਆ ਕੇ ਅਰਦਾਸ ਕਰਦੇ ਹਨ ਲੰਗਰ ਛਕਦੇ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਸਾਂਝੇ ਤੌਰ 'ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਨ ਇੱਥੇ ਕੋਈ ਵੀ ਊਚ ਨੀਚ ਦੀ ਭਾਵਨਾ ਨਹੀਂ ਹੈ ਇਸ ਕਰਕੇ ਜਦੋਂ ਲੋਕ ਇੱਕ ਇੱਕ ਪੰਗਤ ਦੇ ਵਿੱਚ ਬੈਠ ਕੇ ਚਾਹੇ ਉੱਥੇ ਕੋਈ ਉੱਚੀ ਸ਼੍ਰੇਣੀ ਦਾ ਬੈਠਾ ਹੈ ਚਾਹੇ ਕੋਈ ਗਰੀਬ ਮਜ਼ਦੂਰ ਬੈਠਾ ਹੈ ਸਾਰਿਆਂ ਨੂੰ ਬਰਾਬਰ ਇੱਕੋ ਜਿਹਾ ਮ ਜਿਹੜਾ ਹੈਗਾ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ ਇਸ ਕਰਕੇ ਉਹ ਇਹ ਗੱਲਾਂ ਨੂੰ ਜਿਹੜੇ ਸਥਾਨਕ ਲੋਕ ਦੇਖਦੇ ਹਨ ਤਾਂ ਉਹ ਬੜੇ ਪ੍ਰਭਾਵਿਤ ਹੁੰਦੇ ਹਨ ਵੀ ਇਹਨਾਂ ਵਿੱਚ ਕੋਈ ਵੀ ਊਚ ਨੀਚ ਦੀ ਭਾਵਨਾ ਨਹੀਂ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੇ ਹਾਂ ਉਹ ਅਰਦਾਸ ਪੂਰੀ ਹੁੰਦੀ ਹੈ ਤਾਂ ਉਸ ਸਥਾਨਕ ਲੋਕ ਦੀ ਜਾਂ ਉਸ ਉਨ੍ਹਾਂ ਲੋਕਾਂ ਦੀ ਜੋ ਮਨ ਦੀ ਜਿਹੜੀ ਇੱਛਾ ਪੂਰੀ ਹੁੰਦੀ ਹੈ ਤਾਂ ਉਹਨਾਂ ਦਾ ਧਰਮ ਦੇ ਵਿੱਚ ਹੋਰ ਵੱਡਾ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਇਸ ਤਰ੍ਹਾਂ ਜਦੋਂ ਵੀ ਜਿਹੜੀ ਹੈਗੀ ਆ ਧਾਰਮਿਕ ਆਸਥਾ ਇਨ੍ਹਾਂ ਸਥਾਨਾਂ 'ਤੇ ਪੂਰੀ ਹੁੰਦੀ ਹੈ ਤਾਂ ਲੋਕਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਇਹਨਾਂ ਧਾਰਮਿਕ ਅਸਥਾਨਾਂ 'ਤੇ ਬਣਦਾ ਹੈ ਇਸ ਕਰਕੇ ਮੈਂ ਕਹਿੰਦਾ ਹਾਂ ਜਿਹੜੇ ਸਥਾਨਕ ਲੋਕ ਹੈ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਧਰਮ ਨੂੰ ਅਪਣਾਉਂਦੇ ਹਨ